ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇੱਕ ਸਟੂਡੈਂਟ ਹਾਂ ਅਤੇ ਸਟੂਡੈਂਟ ਹੋਣ ਦੇ ਨਾਤੇ ਮੈਂ ਆਪਣਾ ਘਰ ਜਾ ਕੇ ਕੰਮ ਵੀ ਕਰਦੀ ਹਾਂ ਅਤੇ ਕੱਪੜੇ ਧੋਣਾ ਉਹਨਾਂ ਕੰਮਾਂ ਵਿੱਚੋਂ ਇੱਕ ਹੈ ਕੱਪੜੇ ਧੋਣ ਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਵੋਸ਼ਿੰਗ ਮਸ਼ੀਨ ਦੀ ਹੀ ਵਰਤੋਂ ਕਰਦੀ ਹਾਂ ਕਿਉਂਕਿ ਮੇਰੇ ਤੋਂ ਇੰਨਾ ਜ਼ਿਆਦਾ ਸਮਾਂ ਨਹੀਂ ਹੁੰਦਾ ਕਿ ਮੈਂ ਹੱਥਾਂ ਨਾਲ ਕੱਪੜੇ ਧੋਵਾਂ ਅਤੇ ਉਹਨਾਂ ਨੂੰ ਤਾਰ 'ਤੇ ਪਾ ਕੇ ਸੁਕਾਵਾਂ ਇਸ ਕਰਕੇ ਮੈਂ ਵੋਸ਼ਿੰਗ ਮਸ਼ੀਨ ਦੀ ਵਰਤੋਂ ਕਰਦੀ ਹਾਂ ਅਤੇ ਵੋਸ਼ਿੰਗ ਮਸ਼ੀਨ ਦੇ ਵਿੱਚ ਹੀ ਕੱਪੜੇ ਸੁੱਕ ਜਾਂਦੇ ਹਨ ਅਗਰ ਮੈਂ ਆਪਣੇ ਮੰਮਾ ਦੇ ਟਾਈਮ ਦੀ ਗੱਲ ਕਰਾਂ ਤਾਂ ਉਹ ਪਹਿਲਾਂ ਹੱਥਾਂ ਨਾਲ ਕੱਪੜੇ ਧੋਂਦੇ ਸੀ ਅਤੇ ਉਹਨਾਂ ਨੂੰ ਥਾਪੀਆਂ ਨਾਲ ਧੋਂਦੇ ਸੀ ਅਤੇ ਫਿਰ ਤਾਰ 'ਤੇ ਸੁੱਕਣੇੇ ਪਾਉਂਦੇ ਸੀ ਸਾਰਾ ਸਾਰਾ ਦਿਨ ਸੁੱਕਣੇ ਪਾ ਕੇ ਫਿਰ ਜਾ ਕੇ ਉਹ ਸੁੱਕਦੇ ਸੀ ਕੱਪੜੇ ਅਤੇ ਸੂਰਜ ਦੀ ਰੋਸ਼ਨੀ ਨਾਲ ਸੁੱਕਦੇ ਸੀ ਅਤੇ ਉਸ ਟਾਈਮ ਇਸ ਕਰਕੇ ਸਕ ਕੱਪੜੇ ਧੁ ਧੁੱਪੇ ਪਾਉਣ ਦੇ ਕਾਰਨ ਉਹ ਵਿਟਾਮੀਨ ਡੀ ਵੀ ਉਹਨਾਂ ਨੂੰ ਮਿਲਦੀ ਸੀ ਅਤੇ ਉਹਦੇ ਵਿੱਚ ਜਿੰਨੇ ਕੀਟਾਣੂ ਹੁੰਦੇ ਸੀ ਉਹ ਖਤਮ ਹੋ ਜਾਂਦੇ ਸੀ ਮਗਰ ਵੋਸ਼ਿੰਗ ਮਸ਼ੀਨ ਦੇ ਨਾਲ ਚੰਗੀ ਤਰ੍ਹਾਂ ਕੱਪੜੇ ਨਹੀਂ ਧੋਤੇ ਜਾਂਦੇ ਇਸ ਲਈ ਮੈਂ ਇਹ ਕਹਾਵਾਂਗੀ ਹੱਥ ਨਾਲ ਕੱਪੜੇ ਧੋਣਾ ਹੀ ਸਭ ਤੋਂ ਵਧੀਆ ਹੈ